ਅਸੀਂ ਘਰ ਦੇ ਵਿੱਚ ਜੋ ਵੀ ਰੈਸਪੀ ਬਣਾਉਂਦੇ ਹਾਂ ਜੇਕਰ ਉਸ ਰੈਸਪੀ ਦੇ ਵਿੱਚ ਕੋਈ ਚੀਜ਼ ਵੱਧ ਘੱਟ ਪੈ ਜਾਂਦੀ ਹੈ ਘੱਟ ਪੈ ਜਾਵੇ ਤਾਂ ਅਸੀਂ ਉਸ ਚੀਜ਼ ਨੂੰ ਮਾਤਰਾ ਅਨੁਸਾਰ ਵਧਾ ਸਕਦੇ ਹਾਂ ਪਰ ਜੇਕਰ ਵੱਧ ਪੈ ਜਾਵੇ ਤਾਂ ਉਸਦਾ ਟੇਸਟ ਜਿਹੜਾ ਹੈਗਾ ਬਦਲ ਸਕ ਬਦਲ ਜਾਂਦਾ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦਾ ਹੈ ਕਿ ਓਸ ਚੀਜ਼ ਦੀ ਬਰਬਾਦ ਨਾ ਕਰੀਏ ਉਹਦੇ ਵਿੱਚ ਉਹਦਾ ਕੋਈ ਅਲਟਰਨੇਟਿਵ ਪਾ ਕੇ ਜੇਕਰ ਉਹਦਾ ਅਲਟਰਨੇਟਿਵ ਪਾ ਦੇਈਏ ਜਿਵੇਂ ਦਹੀਂ ਆਪਣਾ ਕੋਈ ਰੈਸਪੀ ਅਸੀਂ ਬਣਾਈ ਫਾਰ ਇਗਜ਼ੈਮਪਲ ਉਹਦੇ ਵਿੱਚ ਮਿਰਚ ਨਮਕ ਜ਼ਿਆਦਾ ਪੈ ਗਿਆ ਤਾਂ ਅਸੀਂ ਥੋੜ੍ਹੀ ਵਿੱਚ ਦਹੀਂ ਐਡ ਕਰ ਦਈਏ ਜਾਂ ਮਲਾਈ ਐਡ ਕਰ ਦਈਏ ਤਾਂ ਉਹ ਜਿਹੜੀ ਚੀਜ਼ ਹੈਗੀ ਹੈ ਸਾਡੇ ਖਾਣਯੋਗ ਹੋਜੂਗੀ ਜੇਕਰ ਅਸੀਂ ਉਸ ਚੀਜ਼ ਦੀ ਬਰਬਾਦੀ ਕਰਾਂਗੇ ਤਾਂ ਸਾਨੂੰ ਜਿਹੜਾ ਹੈਗਾ ਆਪਾਂ ਨੂੰ ਗੁਰਬਾਣੀ ਵਿੱਚ ਵੀ ਲਿਖਿਆ ਵੀ ਜਿਹੜਾ ਆਪਾਂ ਨੂੰ ਭੋਜਨ ਮਿਲਿਆ ਉਹਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਆਪਾਂ ਨੂੰ ਭੋਜਨ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ਕਿਸੇ ਦੀ ਹਾਲਤ ਦੇ ਵਿੱਚ ਇਸ ਕਰਕੇ ਜੋ ਵੀ ਰੈਸਪੀ ਅਸੀਂ ਬਣਾਉਂਦੇ ਹਾਂ ਜੇਕਰ ਆਪਾਂ ਕੋਈ ਕੰਮ ਕਰਾਂਗੇ ਗਲਤੀ ਤਾਂ ਹੋਣੀ ਹੋਣੀ ਹੈ ਇਹ ਮੰਨ ਕੇ ਚੱਲੋ ਜੇਕਰ ਗਲਤੀ ਹੁੰਦੀ ਹੈ ਤਾਂ ਆਪਾਂ ਉਸ ਗਲਤੀ ਵਿੱਚ ਸੁਧਾਰ ਕਰਨਾ ਨਾ ਕਿ ਆਪਾਂ ਉਸ ਚੀਜ਼ ਨੂੰ ਐਕਸੈਪਟ ਕਰਨਾ ਆਪਾਂ ਉਹਨੂੰ ਸੁਧਾਰ ਕਰਨਾ ਆਪਾਂ ਉਹ ਰੈਸਪੀ ਜਿਹੜੀ ਬਣਾ ਰਹੇ ਹਾਂ ਉਹਦੇ ਵਿੱਚ ਕੋਈ ਚੀਜ਼ ਅਲਟਰਨੇਟਿਵ ਐਡ ਕਰਕੇ ਉਸ ਰੈਸਪੀ ਨੂੰ ਆਪਾਂ ਖਾਣਯੋਗ ਬਣਾ ਸਕਦੇ ਹਾਂ ਥੈਂਕ ਯੂ